ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਮੈਂ ਆਪਣਾ ਫੋਨ ਚਲਾ ਰਹੀ ਸੀ ਅਤੇ ਚਲਦਾ ਚਲਦਾ ਫੋਨ ਹੈਂਗ ਹੋ ਗਿਆ ਮੈਂ ਕਾਫੀ ਮੁਸ਼ੱਕਤ ਦੇ ਨਾਲ ਫੋਨ ਰੀਸਟਾਰਟ ਕਰ ਲਿਆ ਅਤੇ ਦੇਖਿਆ ਮੇਰਾ ਸਾਰਾ ਡੇਟਾ ਡਲੀਟ ਹੋ ਗਿਆ ਹੈ ਮੈਂ ਕਾਫੀ ਪਰੇਸ਼ਾਨ ਹੋ ਗਈ ਕਿਉਂਕਿ ਇਹਦੇ 'ਚ ਮੇਰਾ ਬਹੁਤ ਸਾਰਾ ਪਰਸਨਲ ਅਤੇ ਓਫਿਸ਼ਅਲ ਡੇਟਾ ਸੀ ਫਿਰ ਇੱਧਰ ਉੱਧਰ ਤੋਂ ਪਤਾ ਕਰਨ 'ਤੇ ਮੈਂ ਸਰਵਿਸ ਸੈਂਟਰ ਜਾ ਕੇ ਸਾਰਾ ਮਾਜਰਾ ਦੱਸਿਆ ਅਤੇ ਫੋਨ ਜਮ੍ਹਾਂ ਕਰਵਾਇਆ ਤਾਂ ਜੋ ਮੇਰਾ ਫੋਨ ਪਹਿਲਾਂ ਵਾਂਗ ਠੀਕ ਹੋ ਕੇ ਮੇਰਾ ਡੇਟਾ ਰਿਕਵਰ ਹੋ ਸਕੇ ਫਿਰ ਅਗਲੇ ਦਿਨ ਜਦ ਮੈਨੂੰ ਮੇਰਾ ਫੋਨ ਵਾਪਸ ਮਿਲਿਆ ਫੋਨ ਚੈੱਕ ਕਰਨ ਤੋਂ ਬਾਅਦ ਮੈਨੂੰ ਸਕੂਨ ਮਿਲਿਆ ਕਿਉਂਕਿ ਮੇਰਾ ਸਾਰਾ ਡੇਟਾ ਪਹਿਲਾਂ ਵਾਂਗ ਮੇਰੇ ਫੋਨ 'ਚ ਸੀ ਉਸ ਦਿਨ ਮੈਂ ਫੈਸਲਾ ਲਿਆ ਅਤੇ ਆਪਣਾ ਸਾਰਾ ਡੇਟਾ ਬੈਕਅਪ ਕਰਕੇ ਆਪਣੇ ਕੰਪਿਊਟਰ 'ਚ ਰੱਖ ਲਿਆ ਇਹਦੇ ਨਾਲ ਇਹ ਯਕੀਨੀ ਹੋ ਗਿਆ ਕਿ ਜੇਕਰ ਅੱਗੇ ਵੀ ਕਦੀ ਇਹੋ ਜਿਹੀ ਮੁਸ਼ਕਲ ਆ ਪਵੇ ਤਾਂ ਮੇਰੇ ਕੋਲ ਡੇਟਾ ਕੰਪਿਊਟਰ 'ਚ ਪਿਆ ਹੋਏਗਾ ਧੰਨਵਾਦ